ਹਾਂ ਸਾਡੇ ਪੰਜਾਬ ਦੇ ਵਿੱਚ ਤਕਨੋਲੋਜੀ ਸੈਕਟਰ ਜਿਹੜਾ ਆ ਉਹ ਸਾਡਾ ਸਾਡੇ ਲਈ ਇੱਕ ਬਹੁਤ ਹੀ ਸਹਿਯੋਗ ਭਰਿਆ ਜਿਹੜਾ ਆ ਉਹ ਰੇ ਰਿਹਾ ਆ ਸਾਡੇ ਬਹੁਤ ਸਾਰੇ ਕੰਮ ਇਸ ਤਕਨੋਲੋਜੀ ਸੈਕਟਰ ਦੇ ਕਾਰਨ ਜਿਹੜੇ ਆ ਆਸਾਨ ਹੋ ਗਏ ਨੇ ਸਾਡੇ ਸਰਕਾਰੀ ਜਿਹੜੀਆਂ ਨੇ ਅਸੀਂ ਸਰਕਾਰੀ ਨੌਕਰੀਆਂ ਜਿਹੜੀਆਂ ਕ ਨੌਕਰੀਆਂ ਦੇ ਲਈ ਅਸੀਂ ਅਪਲਾਈ ਕਰਦੇ ਹਾਂ ਸਰਕਾਰੀ ਉਹਦੀਆਂ ਜਿਹੜੀਆਂ ਸਾਈਟਾਂ ਬਣ ਚੁੱਕੀਆਂ ਨੇ ਹਰੇਕ ਗੌਰਮੈਂਟ ਦੀ ਆਪਣੀ ਆਪਣੀ ਸਾਈਟ ਬਣੀ ਹੋਈ ਆ ਹਰੇਕ ਖੇਤਰ ਦੀ ਆਪਣੀ ਆਪਣੀ ਸਾਈਟ ਬਣੀ ਹੋਈ ਆ ਹਰੇਕ ਐਜੂਕੇਸ਼ਨ ਦੀ ਸਾਈਟ ਅਲੱਗ ਬਣੀ ਹੋਈ ਆ ਸੋ ਅਸੀਂ ਜਿਵੇਂ ਕਿ ਪੇਪਰ ਦਿੰਦੇ ਹਾਂ ਔਰ ਉਹਨਾਂ ਦਾ ਰਿਜ਼ਲਟ ਵੀ ਅਸੀਂ ਔਨਲਾਈਨ ਟੈਕਨੋਲੋਜੀ ਦੇ ਨਾਲ ਚੈੱਕ ਕਰ ਲੈਂਦੇ ਹਾਂ ਸਾਨੂੰ ਕੋਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਧੱਕੇ ਨਹੀਂ ਖਾਣੇ ਪੈਂਦੇ ਹੈਗੇ ਅਸੀਂ ਘਰ ਬੈਠੇ ਹੀ ਆਪਣਾ ਰਿਜ਼ਲਟ ਚੈੱਕ ਕਰ ਲੈਂਦੇ ਹਾਂ ਅਸੀਂ ਕੋਈ ਗੌਰਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਆ ਉਹਦੀ ਕੋਚਿੰਗ ਵੀ ਅਸੀਂ ਔਨਲਾਈਨ ਲੈ ਲੈਂਦੇ ਹਾਂ ਸੋ ਜਿਹੜੀ ਇਹ ਤਕਨੋਲੋਜੀ ਆ ਤਕਨੋਲੋਜੀ ਸਾਡੇ ਲਈ ਇੱਕ ਬਹੁਤ ਹੀ ਲਾਭਦਾਇਕ ਸਿੱਧ ਹੋ ਰਹੀ ਹੈ ਇਸਨੇ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਸੁਖਾਲਾ ਬਣਾ ਦਿੱਤਾ ਅਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਕੋਈ ਨੌਲੇਜ ਲੈਣੀ ਹੋਵੇ ਇਹ ਸਾਡੇ ਲਈ ਹਮੇਸ਼ਾ ਜਿਹੜੀ ਆ ਲਾਭਦਾਇਕ ਬਣੀ ਰਹਿੰਦੀ ਆ ਔਰ ਇਸਦੀ ਮਦਦ ਦੇ ਨਾਲ ਅਸੀਂ ਹਰੇਕ ਕੰਮ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹਾਂ ਅਤੇ ਵੱਧ ਤੋਂ ਵੱਧ ਅਸੀਂ ਜਾਣਕਾਰੀ ਲੈ ਸਕਦੇ ਹਾਂ ਤਕਨੋਲੋਜੀ ਦੇ ਸੈਕਟਰ ਦੇ ਨਾਲ